ਹੈਲੋ ਹਾਂਜੀ ਮੈਡਮ ਤੁਸੀਂ ਕੈਬ ਬੁੱਕ ਕੀਤੀ ਸੀਗੀ ਸਰੋਜ ਜੀ ਬੋਲ ਰਹੇ ਹੈਗੇ ਹੋ ਹਾਂਜੀ ਮੈਡਮ ਜੀ ਕਿੱਥੇ ਜਾਣਾ ਹੈਗਾ ਤੁਸੀਂ ਅੱਛਾ ਜੀ ਨਹੀਂ ਨਹੀਂ ਇੱਦਾਂ ਦੀ ਤਾਂ ਨਹੀਂ ਕੋਈ ਗੱਲ ਹੈਗੀ ਆਫਲਾਈਨ ਵੀ ਹੈਗੀ ਹੈ ਆਨਲਾਈਨ ਵੀ ਹੈਗੀ ਹੈ ਨਹੀਂ ਹੋਇਆ ਕੀ ਮੈਨੂੰ ਜਰਾ ਥੋੜ੍ਹੀ ਵਿਸਥਾਰ ਦੇ ਵਿੱਚ ਦੱਸੋ ਕਿ ਗੱਲ ਕੀ ਹੋਈ ਆ ਹਾਂਜੀ ਅੱਛਾ ਜੀ ਅੱਛਾ

ਅੱਛਾ ਜੀ ਅਤੇ ਫਿਰ ਹੁਣ ਤੁਹਾਡੀ ਪੇਮੈਂਟ ਉਹ ਲੈ ਗਏ ਸੀਗੇ ਫਿਰ ਅੱਛਾ ਅੱਛਾ ਕਿਨ ਕਿੰਨੀ ਪੇਮੈਂਟ ਹੋਈ ਆ ਤੁਹਾਡੀ ਅੱਛਾ ਜੀ ਅਤੇ ਹੁਣ ਤੁਸੀਂ ਕੰਪਲੇਂਟ ਰੇਸ ਕਰਕੇ ਕੀ ਚਾਹੁੰਦੇ ਹੋ ਸਾਡੇ ਤੋਂ ਕੀ ਸਲਊਸ਼ਨ ਚਾਹੁੰਦੇ ਹੋ ਨਹੀਂ ਡਰਾਈਵਰ ਦੀ ਤੁਹਾਨੂੰ ਡਰਾਈਵਰ ਦੀ ਕੰਡੀਸ਼ਨ ਠੀਕ ਲੱਗੀ ਸੀ ਕਿ ਕੀ ਕਿੱਦਾਂ ਸੀਗਾ ਅੱਛਾ ਅੱਛਾ ਅਤੇ ਆਪਣਾ ਕੀ ਕਹਿੰਦੇ ਨੇ ਉਹਨਾਂ ਨੇ ਤਾਂ ਤੁਹਾਡੇ ਨਾਲ ਕੋਈ ਬਦਸਲੂਕੀ ਤਾਂ ਨਹੀਂ ਕੀਤੀ ਉਹਨੇ ਮਤਲਬ ਕੁਛ ਅੱਛਾ ਅੱਛਾ ਅੱਛਾ ਅੱਛਾ ਮੈਂ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਅਤੇ ਥਾਡ ਅ ਵੈਸੇ ਤੁਹਾਡੇ ਕਿੰਨੇ ਐੱਪ 'ਚ ਪਹਿਲੇ ਪੈਸੇ ਸ਼ੋ ਕਰ ਰਹੇ ਸੀ ਅਤੇ ਫਿਰ ਕਿੰਨੇ ਤੁਸੀਂ ਪੇ ਕੀਤੇ ਉਹਨੂੰ ਹਾਂਜੀ ਹਾਂਜੀ ਹਾਂਜੀ ਹਾਂ ਮੈਂ ਸਮਝ ਗਿ ਸਮਝ ਗਿਆ ਕੀ ਤੁਸੀਂ ਡਰਾਈਵਰ ਦਾ ਨੇਮ ਦੱਸ ਸਕਦੇ ਹੋ ਕੀ ਸੀਗਾ ਤੁਹਾਡੇ ਐੱਪ ਦੇ ਵਿੱਚ ਸ਼ੋ ਹੋ ਰਿਹਾ ਹੋਵੇਗਾ

ਅੱਛਾ ਕੈਪਟਨ ਓਕੇ ਮੈਂ ਤੁਹਾਡੀ ਡਿਟੇਲ ਨੋਟ ਕਰ ਲੈਂਦਾ ਡਰਾਈਵਰ ਦਾ ਨੇਮ ਕੈਪਟਨ ਸੀਗਾ ਸਾਡੀ ਕੋਈ ਉਹ ਕੀ ਕਹਿੰਦੇ ਨੇ ਇੱਕ ਡਰਾਈਵਰ ਆਈ ਡੀ ਵੀ ਆਈ ਹੋਣੀ ਆ ਉਹ ਸਲਿਪ ਆਈ ਡੀ ਉਹ ਹਾਂਜੀ ਹਾਂਜੀ ਹਾਂਜੀ ਠੀਕ ਹੈ ਅ ਗੱਡੀ ਦੀ ਕਿਹੜੀ ਰੰਗ ਦੀ ਸੀ ਨੰਬਰ ਵਗੈਰਾ ਵੀ ਉਹਦੇ ਵਿੱਚ ਨਹੀਂ ਤਾਂ ਅੱਗੇ ਐਪ 'ਚ ਸ਼ੋ ਹੋਵੇਗਾ ਤੁਸੀਂ ਚ ਚੈੱਕ ਕਰਕੇ ਦੱਸ ਸਕਦੇ ਹੋ ਹੈਗੇ ਹੋ ਕਿਉਂਕਿ ਮੈਡਮ ਤੁਹਾਨੂੰ ਵੀ ਪਤਾ ਕੰਪਲੇਂਟ ਪਾਉਣੀ ਹੈ ਫਿਰ ਪ੍ਰੋਪਰ ਸਾਰੀ ਮਤਲਬ ਇਨਫੋਰਮੇਸ਼ਨ ਲੈ ਕੇ ਆਪਾਂ ਫਿਰ ਤਾਹੀਓਂ ਉਸ ਬੰਦੇ 'ਤੇ ਐਕਸ਼ਨ ਲੈ ਸਕਦੇ ਨਾ ਕਿ ਜਿੱਦਾਂ ਤੁਹਾਨੂੰ ਜੋ ਪ੍ਰੋਬਲਮ ਹੋਈ ਹੈ ਇੱਦਾਂ ਵਗੈਰਾ ਕਰਕੇ ਹਾਂਜੀ ਹਾਂਜੀ ਜੀ ਅੱਛਾ ਜੀ ਕਿਹੜੀ ਕੰਪਨੀ ਦੀ ਗੱਡੀ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਜੀ ਠੀਕ ਆ ਮੈਂ ਇੱਕ ਮਿੰਟ ਤੁਹਾਡੀ ਡਿਟੇਲ ਜਰਾ ਨੋਟ ਕਰ ਲਵਾਂ ਠੀਕ ਹੈ ਜੀ ਆਪਣਾ ਤੁਸੀਂ ਨਾਮ ਬੋਲਿਓ ਅੱਛਾ ਜੀ ਠੀਕ ਹੈ ਇੱਕ ਸੈਕੰਡ ਫੋਨ ਨੰਬਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਐਡਰੈਸ ਕਿੱਥੇ ਦਾ ਹੈਗਾ ਅੱਛਾ ਜੀ ਠੀਕ ਹੈ ਠੀਕ ਹੈ ਅਤੇ ਚਲੋ ਠੀਕ ਹੈ ਤੁਹਾਡਾ ਅ ਇਸ਼ੂ ਆਪਾਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਅਸੀਂ ਰੀਸੋਲਵ ਕਰਵਾਉਣ ਦੀ ਕੋਸ਼ਿਸ਼ ਠੀਕ ਹੈ ਜੀ ਠੀਕ ਹੈ ਠੀਕ ਠੀਕ ਹੈ ਜੀ ਓਕੇ